ਜੋ ਕਿ ਅਸੀਂ ਐੱਲ ਪੀ ਜੀ ਸਲੰਡਰ ਦੀ ਵਰਤੋਂ ਕਰਦੇ ਆ ਰਹੇ ਹਾਂ ਇਹ ਸਾਡੇ ਲਈ ਬਹੁਤ ਹੀ ਫਾਇਦੇਮੰਦ ਸਿੱਧ ਹੋਈ ਹੈ ਇਸ ਲਈ ਅਸੀਂ ਜਲਦੀ ਜੋ ਕਿ ਸਾਨੂੰ ਪਿਛਲੇ ਟਾਇਮ ਵਿੱਚ ਚੁੱਲੇ 'ਤੇ ਖਾਣਾ ਬਣਾਉਣਾ ਪੈਂਦਾ ਸੀ ਉਸ ਦੇ ਸਾਨੂੰ ਪਹਿਲਾਂ ਉਸ ਲਈ ਅਗ ਲੱਕੜੀਆਂ ਰਾਹੀਂ ਅੱਗ ਬਾਲਣੀ ਪੈਂਦੀ ਸੀ ਜੋ ਕਿ ਜਿਸ 'ਤੇ ਕਿ ਸਾਨੂੰ ਟਾਇਮ ਵੀ ਲੱਗਦਾ ਸੀ ਕਿ ਉਸ ਧੂੰਏ ਨਾਲ ਪ੍ਰਦੂਸ਼ਣ ਫੈਲਦਾ ਸੀ ਜੋ ਕਿ ਸਾਡੇ ਸਿਹਤ ਲਈ ਬਹੁਤ ਹੀ ਹਾਨੀਕਾਰਕ ਸੀ ਇਹ ਸਾਡੇ ਲਈ ਇਸ ਲਈ ਸਹਾਇਕ ਸਿੱਧ ਹੋਇਆ ਹੈ ਕਿ ਅਸੀਂ ਨਾ ਇਸ ਨਾਲ ਪ੍ਰਦੂਸ਼ਣ ਫੈ ਪ੍ਰਦੂਸ਼ਣ ਵੱਧਦਾ ਹੈ ਅਤੇ ਨਾ ਹੀ ਸਾਡੇ ਟਾਇਮ ਨਾ ਹੀ ਸਾਡਾ ਟਾਇਮ ਬਰਬਾਦ ਹੁੰਦਾ ਹੈ ਇਸ ਕਰਕੇ ਇਸ ਕਰਕੇ ਅਸੀਂ ਆਪਣਾ ਖਾਣਾ ਜਲਦੀ ਤੋਂ ਜਲਦੀ ਅਤੇ ਮਿੰਟਾਂ 'ਚ ਬਣਾ ਸਕਦੇ ਹਾਂ ਔਰ ਸਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਸਲੰਡਰ ਨੂੰ ਨੀਚੋਂ ਔਫ ਕਰਨਾ ਚਾਹੀਦਾ ਹੈ ਤਾਂ ਕਿ ਕਿੱਸੇ ਗੱਲ ਦਾ ਖਤਰਾ ਨਾ ਬਣਿਆ ਰਹੇ ਥ